ਹਾਂਜੀ ਮੇਰੇ ਕੋਲ ਇੱਕ ਮਨਪਸੰਦ ਫਿਲਮ ਹੈ ਜੋ ਕਿ ਮੈਂ ਦੇਖੀ ਤੀ ਡੇਢ ਦੋ ਸਾਲ ਪਹਿਲਾਂ ਜੋ ਕਿ ਵਿਵਾਹ ਫਿਲਮ ਨਾਂ ਨਾਲ ਪ੍ਰਸਿੱਧ ਹੈ ਇਹ 'ਚ ਕੁੜੀ ਨਾਲੇ ਮੁੰਡੇ ਮੁੰਡੇ ਵਾਲੇ ਹੁੰਦੇ ਰਿਚ ਫੈਮਲੀ ਦੇ ਕੁੜੀ ਵਾਲੇ ਥੋੜ੍ਹੇ ਮਿਡਲ ਕਲਾਸ ਫੈਮਲੀ ਤੋਂ ਹੁੰਦੇ ਹੈ ਜਦ ਉਹਨਾਂ ਦਾ ਵਿਆਹ ਰੱਖਿਆ ਜਾਂਦਾ ਹੈ ਕੁੜੀ ਆਪਣੇ ਵਿਆਹ ਵਾਲੇ ਦਿਨ ਜਲ ਜਾਂਦੀ ਹੈ ਇਹ ਫਿਰ ਜਲ ਜਾਂਦੀ ਹੈ ਫਿਰ ਮੁੰਡੇ ਵਾਲਿਆਂ ਨੂੰ ਪਤਾ ਲੱਗਦਾ ਹੈ ਮੁੰਡੇ ਵਾਲੇ ਜਾਂਦੇ ਆ ਪਰ ਕੁੜੀ ਦਾ ਸਾਥ ਨਹੀਂ ਛੱਡਦੇ ਮੁੰਡੇ ਵਾਲੇ ਕੁੜੀ ਨੂੰ ਦਵਾਈ ਦਵੂਈ ਕਰਾਉਂਦੇ ਆ ਸਭ ਕੁਛ ਕਰਨ ਤੋਂ ਬਾਅਦ ਕੁੜੀ ਨਾਲ ਫਿਰ ਵਿਆਹ ਕਰਦੇ ਆ ਇਹ ਮੈਨੂੰ ਉਹਨਾਂ ਦੇ ਕਹਾਣੀ ਬਹੁਤ ਵਧੀਆ ਲੱਗੀ ਕਿਉਂਕਿ ਜੋ ਕਿ ਇਹ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਕੁੜੀ ਦੇ ਨਾਲ ਵਧੀਆ ਕਰਿਆ ਮੁੰਡੇ ਵਾਲਿਆਂ ਨੇ ਇਹ ਉਹਨਾਂ ਦੀ ਕਹਾਣੀ ਵਧੀਆ ਕੁੜੀ ਦਾ ਪੂਰਾ ਸਰੀਰ ਜਲਣ ਤੋਂ ਬਾਅਦ ਵੀ ਮੁੰਡੇ ਨੇ ਪੂਰਾ ਸਾਥ ਦਿੱਤਾ ਕੁੜੀ ਵਾਲੇ ਦਾ ਉਹਨਾਂ ਸਾਰਾ ਵਿਆਹ ਵੂ ਕਰਿਆ ਸਾਰਾ ਖਰਚਾ ਚੱਕਿਆ ਦਵਾਈ ਦਵੂਈ ਦਾ ਇਹ ਸਾਨੂੰ ਵਧੀਆ ਲੱਗਿਆ ਦੇਖ ਕੇ ਹਰੇਕ ਬੰਦੇ ਨੂੰ ਵਧੀਆ ਲੱਗਣਾ ਚਾਹੀਦਾ ਮੈਨੂੰ ਹੀ ਨਹੀਂ ਹਰੇਕ ਨੂੰ ਵਧੀਆ ਲੱਗਣਾ ਚਾਹੀਦਾ ਇਹ ਫਿਲਮ ਅੱਜ ਵੀ ਹਰੇਕ ਕੋਈ ਵੀ ਦੇਖਦਾ ਅਤੇ ਜੀ ਖੁਸ਼ ਹੋ ਜਾਂਦਾ ਫਿਲਮ ਦੇਖ ਕੇ ਇਹ ਫਿਲਮ ਵਧੀਆ ਹੈ ਦੇਖਣੀ ਚਾਹੀਦੀ ਇਹਨੂੰ